ਮੋਹਾਲੀ ਜ਼ਿਲ੍ਹੇ ਵਿੱਚ ਪਾਣੀ ਦਾ ਮੁੱਖ ਸਰੋਤ ਧਰਤੀ ਹੇਠਲਾ ਪਾਣੀ ਹੈ ਜਿਹਨੂੰ ਟਿਊਬਲ ਦੇ ਰਾਹੀਂ ਬਾਹਰ ਕੱਢਿਆ ਜਾਂਦਾ ਹੈ ਅਤੇ ਲੋਕਾਂ ਰਾਹੀਂ ਪਹੁੰਚਾਇਆ ਜਾਂਦਾ ਹੈ ਇਸ ਦੇ ਵਿੱਚ ਜੰਗਲੀ ਜ਼ਿਆਦਾਤਰ ਜੰਗਲ ਜ਼ਿਆਦਾਤਰ ਤਾਂ ਸ਼ੀਸਮਾ ਡੈਮ ਦੇ ਕੋਲ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਪਾਇਆ ਜਾਂਦਾ ਹੈ ਅਤੇ ਜੰਗਲਾਂ ਵਿੱਚ ਖਣਿਜ ਪਦਾਰਥ ਵੀ ਮਿਲ ਜਾਂਦੇ ਹਨ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਜਿਉਂ ਜਿਉਂ ਆਬਾਦੀ ਵਧ ਰਹੀ ਹੈ ਸ਼ਹਿਰ ਵਿੱਚ ਪ੍ਰਦੂਸ਼ਣ ਵੀ ਵੱਧਦਾ ਹੀ ਜਾ ਰਿਹਾ ਹੈ ਭਾਵੇਂ ਉਹ ਹਵਾ ਪ੍ਰਦੂਸ਼ਣ ਹੋਵੇ ਭਾਵੇਂ ਧਵਨੀ ਕੋਈ ਵੀ ਪ੍ਰਦੂਸ਼ਣ ਹੋਵੇ ਦੇਖਿਆ ਜਾਵੇ ਤਾਂ ਨਗਰ ਪਾਲਿਕਾ ਵੀ ਸਫਾਈ ਦਾ ਧਿਆਨ ਬਹੁਤ ਰੱਖਦੀ ਹੈ ਪਹਿਲਾਂ ਪੁਰਾਣੇ ਸਮੇਂ ਵਿੱਚ ਥੋੜਾ ਜਦੋ ਗ ਗੰਦਗੀ ਹੁੰਦੀ ਸੀ ਪਰ ਨਗਰ ਪਾਲਿਕਾ ਜਿਉਂ ਜਿਉਂ ਵਿਕਸਿਤ ਹੋ ਰਹੀ ਹੈ ਤਾਂ ਸਫਾਈ ਦਾ ਵੀ ਬਹੁਤ ਧਿਆਨ ਰੱਖ ਰਹੀ ਐ ਸਫਾਈ ਵਾਸਤੇ ਸਫਾਈ ਕਰਮਚਾਰੀ ਰੱਖੇ ਹੋਏ ਹਨ ਹੁਣ ਤਾਂ ਬਹੁਤ ਘੱਟ ਸਥਾਨਾਂ 'ਤੇ ਗੰਦਗੀ ਮਿਲਦੀ ਹੈ ਇਸ ਸਫਾਈ ਦਾ ਜਿਉਂ ਜਿਉਂ ਵਿਕਸਿਤ ਹੋ ਰਿਹਾ ਏ ਤਿਉਂ ਤਿਉਂ ਇਹਨਾਂ ਦੇ ਕੰਮ ਵੀ ਜ਼ਿਆਦਾਤਰ ਵੱਧਦੇ ਜਾ ਰਹੇ ਹਨ